ਸਤਿ ਸ਼੍ਰੀ ਅਕਾਲ ਜੀ ਖਾਣਾ ਪਕਾਉਂਦੇ ਵਕਤ ਬਹੁਤ ਹੀ ਅਲੱਗ ਅਲੱਗ ਤਰ੍ਹਾਂ ਦੇ ਅਸੀਂ ਬਰਤਨਾਂ ਦਾ ਇਸਤੇਮਾਲ ਕਰਦੇ ਹਾਂ ਅਤੇ ਰਸੋਈ ਵਿੱਚ ਸਾਨੂੰ ਬਹੁਤ ਸਾਰੇ ਬਰਤਨ ਦਿਖਣ ਨੂੰ ਵੀ ਮਿਲ ਜਾਂਦੇ ਹਨ ਅਤੇ ਹਰ ਇੱਕ ਬਰਤਨ ਦਾ ਅਲੱਗ ਹੀ ਇਸਤੇਮਾਲ ਹੁੰਦਾ ਹੈ ਜਿਨ੍ਹਾਂ ਵਿੱਚ ਕਈ ਛੋਟੇ ਪਤੀਲੇ ਹੁੰਦੇ ਹਨ ਕੋਈ ਵੱਡੇ ਪਤੀਲੇ ਹੁੰਦੇ ਹਨ ਅਲੱਗ ਅਲੱਗ ਤਰ੍ਹਾਂ ਦੀਆਂ ਕੜਛੀਆਂ ਹੁੰਦੀਆਂ ਹਨ ਛਾਨਣੀਆਂ ਹੁੰਦੀਆਂ ਹਨ ਘੋਟਣਾ ਹੁੰਦਾ ਹੈ ਅਤੇ ਆਪਾਂ ਨੂੰ ਜੋ ਵੀ ਅਪ ਜਦੋਂ ਆਪਾਂ ਕੋਈ ਵੀ ਲੂਣ ਮਿਰਚ ਨੂੰ ਕੁੱਟਣਾ ਹੁੰਦਾ ਹੈ ਅਤੇ ਦੌਰੀ ਵੱਟਾ ਵੀ ਹੁੰਦਾ ਹੈ ਜਿਸਦੇ ਵਿੱਚ ਆਪਾਂ ਕਿਸੇ ਵੀ ਚੀਜ਼ ਨੂੰ ਪੇਸਟ ਦੇ ਵਿੱਚ ਜੋ ਕੋਈ ਵੀ ਮਿਰਚਾਂ ਨੂੰ ਉਹਨੂੰ ਆਪਾਂ ਪੇਸਟ ਦਾ ਰੂਪ ਦੇ ਸਕਦੇ ਹਾਂ ਅਤੇ ਇਸ ਤਰ੍ਹਾਂ ਹੀ ਕੜ ਅਲੱਗ ਅਲੱਗ ਤਰ੍ਹਾਂ ਦੀਆਂ ਕੜਛੀਆਂ ਹੁੰਦੀਆਂ ਹਨ ਜੋ ਸਬਜ਼ੀ ਵਾਸਤੇ ਅਲੱਗ ਹੁੰਦੀਆਂ ਹਨ ਚੌਲਾਂ ਵਾਸਤੇ ਅਲੱਗ ਹੁੰਦੀਆਂ ਹੈ ਜਦੋਂ ਆਪਾਂ ਪੂੜੀਆਂ ਕੱਢਣੀਆਂ ਹੁੰਦੀਆਂ ਹਨ ਆਪਾਂ ਅਲੱਗ ਤਰ੍ਹਾਂ ਦੀ ਕੜਛੀ ਇਸਤੇਮਾਲ ਕੀਤੀ ਜਾਂਦੀ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਪੁਣਨਾ ਹੁੰਦਾ ਹੈ ਤਾਂ ਆਪਾਂ ਛਾਨਣੀ ਦਾ ਇਸਤੇਮਾਲ ਕਰਦੇ ਹਾਂ ਪੌਣੀ ਦਾ ਇਸਤੇਮਾਲ ਕਰਦੇ ਹਾਂ ਆਟਾ ਗੁੰਨ੍ਹਣ ਤੋਂ ਪਹਿਲਾਂ ਜਦੋਂ ਆਪਾਂ ਆਟੇ ਨੂੰ ਛਾਣਦੇ ਹਾਂ ਤਾਂ ਆਪਾਂ ਛਾਨਣੀ ਦਾ ਇਸਤੇਮਾਲ ਕਰਦੇ ਹਾਂ ਇਸ ਤਰ੍ਹਾਂ ਹੀ ਅਲੱਗ ਅਲੱਗ ਖਾਣਾ ਬਣਾਉਣ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਭਾਂਡੇ ਆਪਾਂ ਵਰਤਦੇ ਹਾਂ ਵ ਜਦੋਂ ਆਪਾਂ ਜ਼ਿਆਦਾ ਖਾਣਾ ਬਣਾਉਂਦਾ ਬਣਾਉਣਾ ਹੁੰਦਾ ਹੈ ਆਪਾਂ ਵੱਡੇ ਪਤੀਲੇ ਵਰਤਦੇ ਹਾਂ ਉਹਨਾਂ ਵਿੱਚ ਵੀ ਅਲੱਗ ਅਲੱਗ ਤਰ੍ਹਾਂ ਦੇ ਭਾਂਡੇ ਹੁੰਦੇ ਹਨ ਜਿਵੇਂ ਕਿ ਕ ਸਗਲੇ ਹੁੰਦੇ ਹਨ ਕੁਛ ਕ ਪਤੀਲੀਆਂ ਹੁੰਦੀਆਂ ਹਨ ਅਤੇ ਕੋਈ ਛੋਟੇ ਸਗਲੇ ਹੁੰਦੇ ਹਨ ਜਦੋਂ ਛ ਥੋੜ੍ਹਾ ਖਾਣਾ ਬਣਾਉਣਾ ਹੁੰਦਾ ਹੈ ਤਾਂ ਆਪਾਂ ਛੋਟੇ ਆਪਾਂ ਸਗਲਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਦੋਂ ਆਪਾਂ ਕੋਈ ਵੀ ਜਿਸ ਤਰ੍ਹਾਂ ਉਬਾਲਣੀ ਹੋਵੇ ਚੀਜ਼ ਆਪਾਂ ਕੁੱਕਰ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ ਉਸ ਦੇ ਨਾਲ ਕੁੱਕਰ ਨਾਲ ਬਹੁਤ ਛੇਤੀ ਖਾਣਾ ਬਣ ਜਾਂਦਾ ਹੈ ਅਤੇ ਭਾਰਤ ਦੇ ਇਸ ਤਰ੍ਹਾਂ ਹੀ ਆਪਾਂ ਅਲੱਗ ਅਲੱਗ ਭਾਂਡੇ ਵਰਤਦੇ ਹਾਂ ਰਸੋਈ ਦੇ ਵਿੱਚ ਖਾਣਾ ਬਣਾਉਣ ਦੇ ਲਈ ਅਤੇ ਹਰ ਹਰ ਹਰ ਇੱਕ ਦਾ ਅਲੱਗ ਅਲੱਗ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ